ਹਾਂਜੀ ਬਹੁਤ ਸੁਝਾਅ ਹਨ ਅਸੀਂ ਆਪਣੇ ਵਿਹੜੇ ਵਿੱਚ ਦਾਣੇ ਜਾਂ ਰੋਟੀ ਪਾਉਂਦੇ ਹਾਂ ਉਸ ਨਾਲ ਬਹੁਤ ਸਾਰੇ ਪੰਛੀ ਆ ਜਾਂਦੇ ਹਨ ਜਿਸ ਕਰਕੇ ਸਾਡੇ ਵਿਹੜੇ ਵਿੱਚ ਪੰਛੀਆਂ ਦੀ ਚਹਿਲ ਪਹਿਲ ਲੱਗੀ ਰਹਿੰਦੀ ਹੈ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਪੰਛੀਆਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਲੇਕਿਨ ਅੱਜ ਕੱਲ੍ਹ ਪੰਛੀ ਦੇਖਣ ਨੂੰ ਬਹੁਤ ਘੱਟ ਮਿਲਦੇ ਹਨ ਇਹਨਾਂ ਨੂੰ ਪਿੰਜਰੇ ਵਿੱਚ ਕੈਦ ਕਰਕੇ ਰੱਖਿਆ ਜਾਂਦਾ ਹੈ ਇਸ ਲਈ ਹੁਣ ਪੰਛੀ ਮੌਸਮ ਦੇ ਹਿਸਾਬ ਨਾਲ ਬਹੁਤ ਘੱਟ ਆਉਂਦੇ ਹਨ ਹੁਣ ਚਿੜੀਆਂ ਅਤੇ ਕਾਂ ਬਹੁਤ ਘੱਟ ਦਿਸਦੇ ਹਨ ਪਹਿਲਾਂ ਬਹੁਤ ਵੱਡੀ ਮਾਤਰਾ ਵਿੱਚ ਹੁੰਦੇ ਸਨ ਪੰਛੀ ਬਹੁਤ ਜ਼ਰੂਰੀ ਹੋਣੇ ਚਾਹੀਦੇ ਹਨ ਜੋ ਆਪਣੇ ਘਰਾਂ ਵਿੱਚ ਰੋਟੀ ਬਚੀ ਹੋਈ ਹੁੰਦੀ ਹੈ ਅਸੀਂ ਉਨ੍ਹਾਂ ਨੂੰ ਪਾ ਦਿੰਦੇ ਹਾਂ ਨਹੀਂ ਤਾਂ ਉਹ ਰੋਟੀ ਸਾਨੂੰ ਡੇਗਣੀ ਪੈਂਦੀ ਹੈ ਪੰਛੀਆਂ ਨੂੰ ਲੋਕ ਘਰਾਂ ਵਿੱਚ ਰੱਖਣਾ ਪਸੰਦ ਕਰਦੇ ਹਨ ਜਿਵੇਂ ਕਿ ਚਿੜੀਆਂ ਕਬੂਤਰ ਤੋਤੇ ਰੱਖਦੇ ਹਨ ਇਹਨਾਂ ਨਾਲ ਘਰ ਵਿੱਚ ਰੌਣਕ ਲੱਗੀ ਰਹਿੰਦੀ ਹੈ ਪਹਿਲਾਂ ਸਮੇਂ ਵਿੱਚ ਕਬੂਤਰ ਨੂੰ ਚਿੱਠੀ ਸੰਦੇਸ਼ ਚਿੱਠੀਆਂ ਭੇਜਣ ਲਈ ਵਰਤਿਆ ਜਾਂਦਾ ਸੀ